ਮੈਨੂੰ ਫੁੱਲਾਂ ਵਾਲੇ ਪੌਦੇ ਬਹੁਤ ਹੀ ਪਸੰਦ ਹੈ ਮੈਂ ਗੁਲਾਬ ਦੀਆਂ ਅਤੇ ਮੋਗਰੇ ਦੀਆਂ ਕਲੀਆਂ ਦਾ ਫੁੱਲ ਜਿਹੜਾ ਹੁੰਦਾ ਹੈ ਉਸਦੀਆਂ ਕਲਮਾਂ ਕਈ ਵਾਰ ਲਗਾਈਆਂ ਹਨ ਅਤੇ ਉਹ ਪੌਦੇ ਵੀ ਬਹੁਤ ਹੀ ਭਰਪੂਰ ਤਰ੍ਹਾਂ ਤੋਂ ਉੱਗੇ ਹਨ ਹੁਣ ਵੀ ਥੋੜ੍ਹੇ ਦਿਨਾਂ ਪਹਿਲਾਂ ਵੀ ਮੈਂ ਗੁਲਾਬ ਅਤੇ ਕਲੀਆਂ ਦੀਆਂ ਕਈ ਕਲਮਾਂ ਲਗਾਈਆਂ ਹਨ ਹੁਣ ਵੇਖੋ ਉਸਦਾ ਨਤੀਜਾ ਉਹਨਾਂ ਦਾ ਨਤੀਜਾ ਕੀ ਨਿਕਲਦਾ ਹੈ